ਹਸਪਤਾਲ ਦੇ ਪ੍ਰਬੰਧਨ ਪ੍ਰਬੰਧਨ ਬਾਰੇ ਸਾਡੀ ਇਹ ਹੀ ਰਾਇ ਹੈ ਕਿ ਹਸਪਤਾਲ ਦੇ ਵਿੱਚ ਹ ਮਿਲ ਮਰੀਜ਼ ਦਾ ਇਲਾਜ ਕਰਨ ਲਈ ਹਰ ਇੱਕ ਤਰ੍ਹਾਂ ਦੀ ਪ੍ਰਕਿਰਿਆ ਨਿਰਵਿਘਨ ਹੈ ਮਰੀਜ਼ ਦਾ ਧਿਆਨ ਰੱਖਣ ਲਈ ਹਰ ਇੱਕ ਤਰ੍ਹਾਂ ਦਾ ਸਟਾਫ ਹੈ ਸਟਾਫ ਮਰੀਜ਼ ਦੀ ਦੇਖਭਾਲ ਪੂਰੇ ਗੌਰ ਨਾਲ ਕਰਦਾ ਹੈ ਅਤੇ ਉਹਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਦਿੰਦਾ ਹੈ ਮਰੀਜ਼ ਨੂੰ ਕੋਈ ਵੀ ਇਲਾਜ ਵਿੱਚ ਦਿੱਕਤ ਨਹੀਂ ਆਉਂਦੀ ਅਤੇ ਸਟਾਫ ਵੀ ਬਹੁਤ ਵਧੀਆ ਹੈ ਅਤੇ ਧਿਆਨ ਰੱਖਦਾ ਹੈ ਹਰ ਇੱਕ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਟਾਈਮ ਸ ਸਿਰ ਇਲਾਜ ਕੀਤਾ ਜਾਂਦਾ ਹੈ ਟਾਈਮ ਸਿਰ ਦਵਾਈ ਦਿੱਤੀ ਜਾਂਦੀ ਹੈ ਟਾਈਮ ਟਾਈਮ 'ਤੇ ਮਰੀਜ਼ ਦਾ ਖਿਆਲ ਰੱਖਿਆ ਜਾਂਦਾ ਹੈ ਸੋ ਇਸ ਲਈ ਸਾਨੂੰ ਸਾਡੇ ਹਸਪਤਾਲ ਦੇ ਪ੍ਰਬੰਧਨ ਵਿੱਚ ਕੋਈ ਵੀ ਇੱਦਾਂ ਦੀ ਕਮੀ ਨਹੀਂ ਲੱਗਦੀ ਕਿ ਜਿਸ ਕਾਰਨ ਅਸੀਂ ਕਹਿ ਸਕੀਏ ਕਿ ਸਾਡੇ ਹਸਪਤਾਲ ਦੇ ਪ੍ਰਬੰਧਨ ਬਾਰੇ ਅਸੀਂ ਕੁਝ ਅਜਿਹਾ ਕਹਿ ਸਕੀਏ ਕਿ ਜਿਸ ਨਾਲ ਸਾਨੂੰ ਲੱਗੇ ਕੇ ਇਹ ਵੀ ਸਾਨੂੰ ਕਹਿਣ ਦੀ ਲੋੜ ਹੈ ਸੋ ਸਾਡਾ ਹਸਪਤਾਲ ਦਾ ਪ੍ਰਬੰਧਨ ਬਹੁਤ ਵਧੀਆ ਹੈ ਅਤੇ ਟਾਈਮ ਸਿਰ ਮਰੀਜ਼ ਦਾ ਇਲਾਜ ਅਤੇ ਦੇਖਭਾਲ ਕਰਦਾ ਹੈ